ਅੱਜ ਕੱਲ੍ਹ ਲੋਕ ਭੱਜਣ ਲਈ ਟਰੈਡਮਿਲ ਨਾਮਕ ਮਸ਼ੀਨ ਦਾ ਉਪਯੋਗ ਕਰਦੇ ਹਨ ਇਹ ਮਸ਼ੀਨ ਸਭ ਤੋਂ ਜ਼ਿਆਦਾ ਸ਼ਹਿਰਾਂ ਦੇ ਵਿੱਚ ਪਾਈ ਜਾਂਦੀ ਹੈ ਕਿਉਂਕਿ ਉੱਥੋਂ ਦੇ ਲੋਕ ਜਿੰਮ ਜਾਣਾ ਬਹੁਤ ਪਸੰਦ ਕਰਦੇ ਹਨ ਅਤੇ ਉੱਥੇ ਹੀ ਭੱਜਣ ਦੀ ਵੀ ਕੋਸ਼ਿਸ਼ ਕਰਦੇ ਹਨ ਜਿਸ ਕਾਰਨ ਉਹ ਟਰੈਡਮਿਲ 'ਤੇ ਹੀ ਆਪਣੇ ਆਪ ਨੂੰ ਭਜਾਉਂਦੇ ਹਨ ਦੇਖਿਆ ਜਾਵੇ ਤਾਂ ਟਰੈਡਮਿਲ ਅਤੇ ਜ਼ਮੀਨ 'ਤੇ ਦੌੜਨਾ ਵਿੱਚ ਬਹੁਤ ਫਰਕ ਹੈ ਕਿਉਂਕਿ ਜ਼ਮੀਨ 'ਤੇ ਦੌੜਨ ਨਾਲ ਜਦੋਂ ਬੰਦਾ ਦੌੜਦਾ ਹੈ ਤਾਂ ਉਸਦੇ ਪੈਰ ਇੱਕ ਸਮਤਲ ਜ਼ਮੀਨ 'ਤੇ ਨਹੀਂ ਹੁੰਦੇ ਹਨ ਉਹ ਕਦੇ ਖੱਡੇ ਵਿੱਚ ਜਾਂਦੇ ਹਨ ਕਦੇ ਰੋੜਿਆਂ 'ਤੇ ਪੈਂਦੇ ਹਨ ਕਦੇ ਘਾਹ 'ਤੇ ਪੈਂਦੇ ਹਨ ਤਾਂ ਉਸਨੂੰ ਹਰ ਤਰ ਹਰ ਮਾਹੌਲ ਵਿੱਚ ਦੌੜਨ ਦੀ ਆਦਤ ਹੋ ਜਾਂਦੀ ਹੈ ਪਰ ਟਰੈਡਮਿਲ ਉੱਤੇ ਦੌੜਨ ਨਾਲ ਪਹਿਲੀ ਗੱਲ ਤਾਂ ਪੈਰਾਂ ਦੀ ਇੰਜਰੀ ਵੀ ਹੋ ਸਕਦੀ ਹੈ ਅਤੇ ਗੋਡਿਆਂ ਦਾ ਹਿੱਲਣਾ ਵੀ ਬਹੁਤ ਲਾਜ਼ਮੀ ਹੈ ਟਰੈਡਮਿਲ 'ਤੇ ਭੱਜਣ ਨਾਲੋਂ ਤਾਂ ਲੋਕ ਜ਼ਮੀਨ 'ਤੇ ਹੀ ਭੱਜਣ ਉਹ ਹੀ ਚੰਗਾ ਹੈ